ਭਾਰਤ ਵਿੱਚ ਵੈਸੇ ਮੇਰਾ ਮਨਪਸੰਦ ਰਾਜ ਪੰਜਾਬ ਹੈ ਕਿਉਂਕਿ ਮੈਂ ਬੇਸਿਕਲੀ ਪੰਜਾਬ ਤੋਂ ਬਲੌਂਗ ਕਰਦਾ ਹਾਂ ਅਤੇ ਕਿਉਂਕਿ ਇਹ ਮੈਨੂੰ ਪਸੰਦ ਤਾਂ ਹੈ ਕਿਉਂਕਿ ਇਹ ਮੇਰਾ ਖੁਦ ਦਾ ਆਪਣਾ ਪੰਜਾਬ ਹੈ ਕਿਉਂਕਿ ਇੱਥੋਂ ਦੇ ਲੋਕ ਆ ਜਿਹੜੇ ਬਹੁਤ ਵਧੀਆ ਨੇ ਖੁਸ਼ਹਾਲ ਨੇ ਅਤੇ ਜਿਹੜੀ ਇੱਥੋਂ ਦੀ ਮਿੱਟੀ ਆ ਉਹ ਬੜੀ ਉਪਜਾਊ ਆ ਅਤੇ ਜਿਹੜਾ ਇੱਥੋਂ ਦਾ ਵਾਤਾਵਰਨ ਆ ਉਹ ਬੜਾ ਸ਼ੁੱਧ ਮੰਨਿਆ ਜਾਂਦਾ ਹੈ ਅਤੇ ਇੱਥੇ ਜਿਹੜਾ ਪਾਣੀ ਹੈ ਪੀਣ ਵਾਲਾ ਪਾਣੀ ਹੈ ਉਸ ਦਾ ਉਹ ਵੀ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਕਈ ਤ ਤੱਤ ਪਾਏ ਜਾਂਦੇ ਹਨ ਪਾਣੀ 'ਚ ਜੋ ਕਿ ਹੋਰ ਰਾਜ ਦੇ ਵਿੱਚ ਨਹੀਂ ਮਿਲਦੇ ਅਤੇ ਜਿਹੜਾ ਪੰਜਾਬ ਵਿੱਚ ਸਭ ਤੋਂ ਵੱਧ ਫਸਲਾਂ ਪੈਦਾ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਝੋਨਾ ਹੋ ਗਿਆ ਕਣਕ ਹੋ ਗਈ ਜਾਂ ਕਪਾਹ ਹੋ ਗਈ ਹੈ ਅਤੇ ਇਹ ਜਿਹੜਾ ਫਸਲ ਹੈ ਪੰਜਾਬ ਹੈ ਇਹ ਹੋਰ ਸਟੇਟਾਂ ਨੂੰ ਵੀ ਸਪਲਾਈ ਕਰਦਾ ਹੈ ਕਣਕ ਹੋ ਗਿਆ ਝੋਨਾ ਹੋ ਗਿਆ ਅਤੇ ਜਿਹੜਾ ਇੱਥੋਂ ਦਾ ਖਾਣ ਪੀਣ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਜਿਵੇਂ ਕਿ ਦੇਸੀ ਘੀ ਹੈ ਦੁੱਧ ਆ ਮੱਖਣੀ ਹੈ ਠੀਕ ਹੈ ਅਤੇ ਇੱਥੋਂ ਦੇ ਲੋਕ ਆ ਜਿਹੜੇ ਜ਼ਿਆਦਾ ਕਰਕੇ ਡੇਅਰੀ ਫਾਰਮਿੰਗ ਰੀਲੇਟਿਡ ਹੀ ਧੰਦਾ ਕਰਦੇ ਨੇ ਅਤੇ ਦੁੱਧ ਦੀ ਪੈਦਾਵਾਰ ਸਭ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਅਤੇ ਇੱਥੋਂ ਜਿਹੜੀਆਂ ਨਸਲਾਂ ਨੇ ਗਊ ਗਾਂ ਦੀਆਂ ਨਸਲਾਂ ਨੇ ਜਾਂ ਪੰਜਾਬ ਵਿੱਚ ਮੱਝ ਦੀਆਂ ਨਸਲਾਂ ਨੇ ਉਹ ਸਭ ਨਾਲੋਂ ਵਧੀਆ ਪਾਈਆਂ ਜਾਂਦੀਆਂ ਨੇ ਅਤੇ ਜੇਕਰ ਮੈਂ ਘੁੰਮਣ ਦੀ ਗੱਲ ਕਰਾਂ ਤਾਂ ਮੈਨੂੰ ਮੇਰੇ ਨਾਲ ਦਾ ਗੁਆਂਢੀ ਸੂਬਾ ਹੈ ਜਿਹੜਾ ਹਿਮਾਚਲ ਹੈ ਉਹ ਮੈਨੂੰ ਬੜਾ ਵਧੀਆ ਲੱਗਦਾ ਹੈ ਅਤੇ ਮੈਂ ਉੱਥੇ ਜਾਣਾ ਵੀ ਚਾਹੁੰਦਾ ਅਤੇ ਕਦੀ ਕਦਾਈਂ ਜਾਂਦਾ ਵੀ ਹਾਂ ਪਰ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਅਤੇ ਤਕਰੀਬਨ ਛੇ ਮਹੀਨੇ 'ਚ ਨੂੰ ਮੈਂ ਜਾਣਾ ਚਾਹੁੰਦਾ ਹਾਂ ਉੱਥੇ ਕਿ ਦੇਖਾਂ ਉੱਥੋਂ ਦੇ ਲੋਕ ਆ ਜਿਹੜੇ ਉਹ ਕਿੱਦਾਂ ਦੇ ਨੇ ਅਤੇ ਕਿੱਦਾਂ ਉਨ੍ਹਾਂ ਦਾ ਰਹਿਣਾ ਸਹਿਣਾ ਹੈ ਕਿਉਂਕਿ ਉਹ ਸਾਰਾ ਜਿਹੜਾ ਹਿਮਾਚਲ ਦਾ ਇਲਾਕਾ ਉਹ ਪਹਾੜੀ ਇਲਾਕਾ ਹੈ ਅਤੇ ਉੱਥੋਂ ਜਿਹੜਾ ਰਹਿਣਾ ਸਹਿਣਾ ਹੈ ਨਾ ਉਹ ਪੰਜਾਬ ਨਾਲੋਂ ਬਿਲਕੁਲ ਵੱਖਰਾ ਹੈ ਅਤੇ ਗੱਲ ਕਰੀਏ ਤਾਂ ਉੱਥੇ ਮੌਸਮ ਆ ਜਿਹੜਾ ਉਹ ਕਾਫੀ ਠੰਢਾ ਰਹਿੰਦਾ ਹੈ ਕਿਉਂਕਿ ਉੱਥੇ ਦਰਖਤ ਵਗੈਰਾ ਕਾਫੀ ਪਾਏ ਜਾਂਦੇ ਨੇ